ਹੈਲੋ ਗੁਡ ਈਵਨਿੰਗ ਸਰ ਯੈੱਸ ਯੂ ਹੈਵ ਆ ਤੁਸੀਂ ਬੁਲਾਇਆ ਸੀ ਕੁਛ ਡਿਸਕਸ ਕਰਨ ਲਈ ਹਾਂ ਯੈੱਸ ਸਰ ਮੈਂ ਵੀ ਇਹ ਇਹ ਮਹਿਸੂਸ ਕਰ ਰਹੀ ਸੀ ਕਿ ਬੱਚਿਆਂ ਦਾ ਇਹ ਬੈਗ ਦਾ ਲੋਡ ਬਹੁਤ ਵਧ ਰਿਹਾ ਹੈ ਅਤੇ ਬੱਚਿਆਂ ਨੂੰ ਬੈਗ ਚੱਕਣਾ ਵੀ ਮੁਸ਼ਕਿਲ ਹੋ ਰਿਹਾ ਅਤੇ ਕੰਪਨੀਆਂ ਨੇ ਅੱਜ ਕੱਲ੍ਹ ਤਾਂ ਬੈਗ ਵੀ ਬੀਲ ਵਾਲੇ ਬਣਾ ਦਿੱਤੇ ਆ ਕਿ ਉਹ ਬੱਚੇ ਈਜ਼ੀਲੀ ਕੈਰੀ ਕਰ ਸਕਣ ਪਰ ਸਕੂਲਾਂ ਨੂੰ ਵੀ ਇਹ ਪੋਲਸੀ ਅਪਣਾਉਣੀ ਪਊਗੀ ਅਤੇ ਜਿਹਦੇ ਨਾਲ ਉਹਨਾਂ ਦਾ ਇਹ ਲੋਟ ਜਿਹੜਾ ਹੈ ਉਹਨਾਂ ਦਾ ਬੈਗ ਦਾ ਭਾਰ ਘੱਟ ਕੀਤਾ ਜਾਵੇ ਜਾਂ ਉਹ ਬਿਨਾਂ ਬੈਗ ਤੋਂ ਹੀ ਸਕੂਲ ਦਾ ਆਪਣੀ ਪੜ੍ਹਾਈ ਦੀ ਪ੍ਰਕਿਰਿਆ ਨੂੰ ਜਾਰੀ ਰੱਖ ਸਕਣ ਅਤੇ ਮੇਰਾ ਸੁਝਾਅ ਇਹ ਹੋਵੇਗਾ ਕਿ ਬੱਚਿਆਂ ਦੀ ਪੜ੍ਹਾਈ ਦਾ ਕੰਮ ਜਿੰਨਾ ਵੀ ਹੋਵੇ ਉਹ ਸਕੂਲ ਵਿੱਚ ਹੀ ਹੋਵੇ ਟੀਚਰ ਆਪਣੇ ਸਬਜੈਕਟ ਦਾ ਬਿਲਕੁਲ ਫਸਟ ਪਲੈਨਿੰਗ ਕਰਨ ਅਤੇ ਉਹਨਾਂ ਨੂੰ ਜੋ ਕਲਾਸਵਰਕ ਕਰਾਉਣ ਉਹਦੇ ਨਾਲ ਹੀ ਰਿਲੇਟਡ ਹੋਮ ਵਰਕ ਵੀ ਉਹ ਬੱਚੇ ਇਜੀਲੀ ਕਰ ਸਕਣ ਅਤੇ ਇੱਕ ਘੰਟਾ ਉਹਨਾਂ ਨੂੰ ਸਕੂਲ ਤੋਂ ਬਾਅਦ ਜਾਂ ਅੱਧਾ ਘੰਟਾ ਜਾਂ ਥੋੜ੍ਹਾ ਟਾਈਮ ਦਿੱਤਾ ਜਾਵੇ ਜਿਹਦੇ ਵਿੱਚ ਉਹ ਆਪਣਾ ਕਲਾਸ ਵਰਕ ਔਰ ਹੋਮਵਰਕ ਹੋਮਵਰਕ ਵਗੈਰਾ ਕਰ ਸਕਣ

ਹਾਂ ਬਿਲਕੁਲ ਇਹ ਸਾਰੇ ਸਾਰੇ ਸਬਜੈਕਟ ਟੀਚਰਾਂ ਨੂੰ ਇਹ ਪਲੈਨਿੰਗ ਕਰ ਲੈਣੀ ਚਾਹੀਦੀ ਹੈ ਵੀ ਜਿਸ ਦਿਨ ਮੈਥ ਦਾ ਟੀਚਰ ਹੋਮ ਵਰਕ ਦੇ ਰਿਹਾ ਉਸ ਦਿਨ ਇੰਗਲਿਸ਼ ਵਾਲਾ ਨਾ ਦਵੇ ਜਿਸ ਦਿਨ ਇੰਗਲਿਸ਼ ਵਾਲਾ ਦੇ ਰਿਹਾ ਹੈ ਅਤੇ ਉਸ ਦਿਨ ਐਸ ਐਸ ਵਾਲਾ ਨਾ ਦਵੇ ਅਤੇ ਘੱਟੋ ਘੱਟ ਹੋਮ ਵਰਕ ਦੋ ਹੋਮ ਵਰਕ ਹੁਣ ਦੋ ਤਿੰਨ ਹੋਮਵਕ ਹੀ ਹੋਣੇ ਚਾਹੀਦੇ

ਠੀਕ ਹੈ ਠੀਕ ਹੈ ਸਰ ਕੱਲ੍ਹ ਮੀਟਿੰਗ ਦੇ ਵਿੱਚ ਗੱਲ ਕਰਾਂਗੇ ਠੀਕ ਹੈ ਸਰ ਓਕੇ ਗੁਡ ਈਵਨਿੰਗ